ਮੇਰਾ ਨਾਮ ਰਾਕੇਸ਼ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਤੇ ਜੇ ਮੈਂ ਗੱਲ ਕਰਾਂ ਤਾਂ ਤਿਉਹਾਰਾਂ ਜਾਂ ਧਾਰਮਿਕ ਮੌਕਿਆਂ 'ਤੇ ਮੈਂ ਦੇਵਤਿਆਂ ਅਤੇ ਦੇਵੀਆਂ ਦੀਆਂ ਕਈ ਮੂਰਤੀਆਂ ਬਣਾਈਆਂ ਹਨ ਅਤੇ ਵੈਸੇ ਮੈਨੂੰ ਕਾਫੀ ਤਰ੍ਹਾਂ ਦੇ ਕਾਫੀ ਚੀਜ਼ਾਂ ਦਾ ਸ਼ੌਕ ਵੀ ਹੈ ਜਿਹਨਾਂ ਵਿੱਚੋਂ ਮੇਰਾ ਇੱਕ ਸ਼ੌਕ ਹੈ ਅਲੱਗ ਅਲੱਗ ਚੀਜ਼ਾਂ ਦੇ ਨਾਲ ਨਵੀਆਂ ਨਵੀਆਂ ਕਲਾਕ੍ਰਿਤੀਆਂ ਬਣਾਉਣਾ ਮੈਂ ਆਪਣੇ ਵਿਹਲੇ ਟਾਇਮ ਵੱਖ ਵੱਖ ਚੀਜ਼ਾਂ ਬਣਾਉਂਦੀ ਰਹਿੰਦੀ ਹਾਂ ਪਿਛਲੇ ਸਾਲ ਦੀ ਗੱਲ ਕਰਾਂ ਤਾਂ ਮੇ ਗਣੇਸ਼ਚਤੁਰਥੀ 'ਤੇ ਇੱਕ ਮੂਰਤੀ ਬਣਾਈ ਸੀ ਜਿਸ ਵਿੱਚੋਂ ਮੈਂ ਬਜ਼ਾਰ ਤੋਂ ਕਲੇਅ ਵਾਲੀ ਮਿੱਟੀ ਦੇ ਨਾਲ ਗਣੇਸ਼ ਜੀ ਦੀ ਇੱਕ ਛੋਟੀ ਜਿਹੀ ਸੁੰਦਰ ਪ੍ਰਤਿਮਾ ਮੂਰਤੀ ਤਿਆਰ ਕੀਤੀ ਜੋ ਕਿ ਮੈਂ ਆਪਣੇ ਘਰ ਦੇ ਮੰਦਿਰ ਵਿੱਚ ਸਜਾਈ ਹੋਈ ਸੀ ਅਤੇ ਉਸ ਉੱਤੇ ਮੈਂ ਬਹੁਤ ਸੋਹਣੇ ਸੋਹਣੇ ਰੰਗਾਂ ਦੇ ਨਾਲ ਪੇਂਟ ਵੀ ਕੀਤਾ ਅਤੇ ਉਸਨੂੰ ਬਣਨ ਤੋਂ ਬਾਅਦ ਉਸਨੂੰ ਕੁਝ ਕੁ ਘੰਟੇ ਧੁੱਪੇ ਸੁੱਕਣੇ ਪਾ ਰੱਖਿਆ ਸੀ ਅਤੇ ਜਦੋਂ ਉਹ ਚੰਗੀ ਤਰ੍ਹਾਂ ਸੁੱਕ ਗਈ ਮਜ਼ਬੂਤ ਹੋ ਗਈ ਤਾਂ ਮੈਂ ਉਸਨੂੰ ਕਦੀ ਮੌਕਾ ਮਿਲੇਗਾ ਮੈਂ ਮੈਨੂੰ ਅੱਗੇ ਤੋਂ ਵੀ ਕਦੀ ਮੌਕਾ ਮਿਲੇਗਾ ਜਾਂ ਵਿਹਲਾ ਟਾਇਮ ਮਿਲੇਗਾ ਤਾਂ ਮੈਂ ਕਈ ਹੋਰ ਮੂਰਤੀਆਂ ਬਣਾਉਣ ਬਾਰੇ ਵੀ ਸੋਚਾਂਗੀ ਇਸੀ ਤਰ੍ਹਾਂ ਹੀ ਜੇ ਕਿਸੇ ਨੂੰ ਵੀ ਕੋਈ ਸ਼ੌਕ ਹੋਏ ਮੂਰਤੀਆਂ ਬਣਾਉਣ ਦਾ ਕਿਸੇ ਵੀ ਕਲਾਕ੍ਰਿਤੀ ਦਾ ਤਾਂ ਉਸਨੂੰ ਕਦੇ ਵੀ ਆਪਣੇ ਅੰਦਰ ਛੁਪਾ ਕੇ ਨਹੀਂ ਰੱਖਣਾ ਚਾਹੀਦਾ ਇਸ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਮੂਰਤੀਆਂ ਨੂੰ ਸਗੋਂ ਬਣਾਉਣਾ ਚਾਹੀਦਾ ਹੈ ਤਾਂ ਜੋ ਇੱਕ ਤਾਂ ਸਾਡੀ ਰੁਝਾਨ ਜੋ ਹੈ ਉਹ ਹੋਬੀ ਜੋ ਹੈ ਓਹ ਉਭਰ ਕੇ ਆਉਂਦੀ ਹੈ ਅਤੇ ਅਸੀਂ ਆਪਣੇ ਮਨ ਨੂੰ ਵੀ ਇਸ ਦੇ ਨਾਲ ਖੁਸ਼ੀ ਜਿਹੜੀ ਹੈ ਦਿੰਦੇ ਹਾਂ ਆਪਣਾ ਜਿਹੜਾ ਅਸੀਂ ਸ਼ੌਕ ਹੈ ਸ਼ੌਕ ਦੇ ਨਾਲ ਜੋ ਸਾਡੇ ਮਨ ਨੂੰ ਖੁਸ਼ੀ ਮਿਲਦੀ ਹੈ ਉਸ ਤੋਂ ਵੱਧ ਕੋਈ ਖੁਸ਼ੀ ਨਹੀਂ ਹੁੰਦੀ ਸਗੋਂ ਇਹੋ ਜਿਹੇ ਮੌਕਿਆਂ 'ਤੇ ਤਿਉਹਾਰਾਂ ਦੇ ਉੱਤੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਬਣਾਉਣਾ ਚਾਹੀਦਾ ਹੈ ਧੰਨਵਾਦ